ਪਿੰਡਾਂ ਵਿੱਚ ਖੇਡਾਂ ਖੇਡਣ ਨਾਲ ਹੁਨਰ ਵਿਕਸਿਤ ਤਾਂ ਵਿਕਸਿਤ ਹੁੰਦੇ ਨੇ ਜਿਵੇਂ ਕਿ ਇੱਕ ਤਾਂ ਬੰਦੇ ਨੂੰ ਦੂਜਿਆਂ ਦੇ ਨਾਲ ਤਾਲ ਮੇਲ ਬਿਠਾਉਣਾ ਵੈਸੇ ਤਾਂ ਜ਼ਿਆਦਾਤਰ ਕ੍ਰਿਕਟ ਦਾ ਬਹੁਤ ਹੁਣ ਅੱਜ ਕੱਲ੍ਹ ਰੁਝਾਨ ਹੈਗਾ ਹੋਰ ਵੀ ਬਹੁਤ ਹੈਗੇ ਨੇ ਜਿਹੜੇ ਖੇਡਾਂ ਪ੍ਰਚਲਿਤ ਨੇ ਜਿਵੇਂ ਕਿ ਕਬੱਡੀ ਵਗੈਰਾ ਕੁਸ਼ਤੀ ਵਗੈਰਾ ਕਰ ਲਈ ਓਹਦੇ ਨਾਲ ਕੀ ਹੈ ਸਰੀਰ ਤਕੜੇ ਹੋ ਜਾਂਦੇ ਨੇ ਮਤਲਬ ਜ਼ੋਰ ਮਾਰਦੇ ਨੇ ਨੌਜਵਾਨ ਮੁੰਡੇ ਤਾਂ ਫਿਰ ਉਹਨਾ ਨੂੰ ਖੁਰਾਕਾਂ ਜਿਹੜੀਆਂ ਖਾਂਦੇ ਨੇ ਉਹ ਲੱਗਦੀਆਂ ਨੇ ਅਤੇ ਉਹ ਤਕੜੇ ਹੋਣ ਦੇ ਨਾਲ ਨਾਲ ਉਹ ਫਿਰ ਆਪਣੀ ਜਿਹੜੀ ਹੈਗੀ ਹੈ ਜਿਹੜੀ ਸਰੀਰਿਕ ਬਲ ਹੈ ਉਹਦੇ ਵਿੱਚ ਜ਼ਿਆਦਾ ਆ ਜਾਂਦਾ ਬਾਕੀ ਸਰੀਰਿਕ ਬਲ ਦੇ ਨਾਲ ਨਾਲ ਮਾਨਸਿਕ ਬਲ ਦੀ ਵੀ ਤਰੱਕੀ ਹੁੰਦੀ ਓਹ ਹੈ ਜਦੋਂ ਖੇਡਦੇ ਹਾਂ ਸਾਨੂੰ ਪਤਾ ਲੱਗਦਾ ਵੀ ਅਸੀਂ ਕਿਵੇਂ ਕਿਵੇਂ ਕਿਵੇਂ ਜਿੱਤਣਾ ਹਾਰ ਜਿਹੜੀ ਹੈਗੀ ਹੈ ਉਹ ਤਾਂ ਚਲੋ ਬਾਅਦ ਦੀਆਂ ਗੱਲਾਂ ਨੇ ਪਰ ਜਿੱਤ ਹਾਰ ਦੇ ਵਿੱਚ ਬੰਦੇ ਦੇ ਇੱਕ ਮਨ ਦੇ ਵਿੱਚ ਹੁੰਦਾ ਖਿਆਲ ਕਿ ਮੈਂ ਵੀ ਜਿੱਤਾਂ ਅਤੇ ਉਹ ਕਿਸ ਤਰੀਕੇ ਨਾਲ ਜਿੱਤਿਆ ਜਾ ਸਕਦਾ ਓਹਦੇ ਵਿੱਚ ਉਹਦੀਆਂ ਮਾਨਸਿਕ ਬੁੱਧੀ ਆ ਜਿਹੜੀ ਦਿਮਾਗ ਦੀ ਜਿਹੜੀ ਵਰਤੋਂ ਹੈ ਓਹ ਹੁੰਦੀ ਹੈ ਅਤੇ ਦਿਮਾਗ ਦੀ ਵਰਤੋਂ ਹੋਣ ਦੇ ਨਾਲ ਫਿਰ ਓਹਦੀ ਜਿਹੜੀ ਹੈਗੀ ਹੈ ਬਲ ਦੇ ਨਾਲ ਨਾਲ ਹੈ ਨਾ ਸਰੀਰਿਕ ਬਲ ਤਾਂ ਦੂਜਾ ਹੋ ਗਿਆ ਵੱਧਦਾ ਹੀ ਹੈ ਬਲਕਿ ਮਾਨਸਿਕ ਬੁੱਧੀ ਹੈ ਜਿਹੜੀ ਓਹਦੇ ਵਿੱਚ ਵੀ ਵਿਕਾਸ ਹੋ ਜਾਂਦਾ ਅਤੇ ਨਾਲੇ ਲੋਕਾਂ ਦੇ ਨਾਲ ਮਿਲ ਕੇ ਜੁਲ ਕੇ ਰਹਿ ਕੇ ਕਿਵੇਂ ਖੇਡੀ ਦਾ ਕਿਵੇਂ ਰਹੀ ਦਾ ਵਿਚਰੀ ਦਾ ਆਪਸ ਦੇ ਵਿੱਚ ਇਹਨਾਂ ਚੀਜ਼ਾਂ ਬਾਰੇ ਵੀ ਬਹੁਤ ਕੁਛ ਪਤਾ ਲਗਦਾ ਜੇ ਬੰਦਾ ਖੇਡਾਂ ਦੇ ਵਿੱਚ ਰੁਝਾਨ ਲੈਂਦਾ